ਹੈਲੋ ਹੈਲੋ ਹਾਂਜੀ ਹੈਲੋ ਹਾਂਜੀ ਤੁਸੀਂ ਰਜਨਦੀਪ ਬੁਟੀਕ ਤੋਂ ਬੋਲ ਰਹੇ ਹੋ ਜੀ ਹਾਂਜੀ ਮੈਮ ਅਸੀਂ ਤੁਹਾਨੂੰ ਪਲਾਜੋ ਸਟਿਚ ਕਰਨਾ ਦੇ ਕੇ ਗਈ ਸੀ ਜੀ ਮੈਂ ਉਹ ਥੁਹਾਨੇ ਸਟਿਚ ਕਰਤਾ ਜੀ ਅਸੀਂ ਅਸੀਂ ਬਠਿੰਡੇ ਤੋਂ ਬੋਲਦੇ ਹਾਂ ਜੀ ਹਾਂਜੀ ਮੈਮ ਅਤੇ ਉਹ ਨਾ ਮੇਰਾ ਉਹ ਜਿਹੜਾ ਪਲਾਜ਼ੋ ਹੈ ਉਹ ਉੱਚਾ ਰਹਿ ਗਿਆ ਅਤੇ ਹਾਂਜੀ ਮੈਂ ਸ ਮੈਂ ਉਹਦਾ ਗ੍ਰੀਨ ਕਲਰ ਸੀਗਾ ਹਾਂਜੀ ਅਤੇ ਮੈਂ ਉਹ ਸਟਿਚ ਕਰਨਾ ਦੇ ਕੇ ਗਈ ਹੋਈ ਸੀ ਤੁਹਾਨੂੰ ਅਤੇ ਉਹਦੀ ਪੇਮੈਂਟ ਵੀ ਹੋਈ ਹੋਈ ਹੈ ਅਤੇ ਉਹ ਨਾ ਉੱਚਾ ਹਾਂਜੀ ਉਹ ਉੱਚਾ ਹੈਗਾ ਅਤੇ ਤੁਹਾਡੇ ਕੋਲ ਮੈਮ ਕੱਪੜਾ ਪਿਆ ਹੋਊਗਾ ਜੀ ਹਾਂਜੀ ਮੈਮ ਮਾੜਾ ਜਿਹਾ ਦੇਖ ਕੇ ਉਹ ਕਰਿਓ ਜੀ ਅਤੇ ਮੇਰਾ ਉਹ ਉੱਚਾ ਰਹਿ ਗਿਆ ਅਤੇ ਉਹਦੀ ਮੈਂ ਪੇਮੈਂਟ ਵੀ ਕਰ ਗਈ ਸੀ ਅਤੇ ਪਰ ਮੈਨੂੰ ਉਹ ਸੈਟ ਨਹੀਂ ਆਇਆ ਉਹ ਉਹਦੀ ਚਾਰ ਇੰਚ ਦੀ ਲੰਬਾਈ ਘੱਟ ਹੈ ਜੀ ਹਾਂਜੀ ਹਾਂਜੀ ਅਤੇ ਕੋਈ ਗੱਲ ਨਹੀਂ ਮੈਂ ਲੈਸ ਵਗੈਰਾ ਤੁਹਾਨੂੰ ਲੈ ਕੇ ਦੇ ਜਾਊਂਗੀ ਅਤੇ ਉਹ ਨਾ ਉੱਚਾ ਕ ਹ ਨੀਵਾਂ ਕਰਨਾ ਹੈਗਾ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਮੈਮ ਉਹ ਕਮੀਜ਼ ਨਾਲ ਦੀ ਕੰਟਰਾਸਟ ਕਰਦੂੰ ਕਰ ਦਾਂਗੇ ਕਮੀਜ਼ ਨਾਲ ਦੀ ਲੈਸ ਲੈ ਕੇ ਦੇ ਜੂੰਗੀ ਤੁਹਾਨੂੰ ਅਤੇ ਉਹ ਮੇਰਾ ਠੀਕ ਕਰਕੇ ਦੇ ਦਿਓ ਅਤੇ ਮੈਂ ਤੁਹਾਨੂੰ ਉਹਦੇ ਵੀ ਉਹੀ ਪੇਮੈਂਟ ਦੇ ਵਿੱਚ ਹੀ ਤੁਹਾਨੂੰ ਸੈਟ ਕਰਕੇ ਦੇਣਾ ਪਊਗਾ ਮੈਂ ਤੁਹਾਨੂੰ ਫਾਇਵ ਹੰਡਰ ਰੁਪੀਸ ਹਾਂਜੀ ਅਤੇ ਬਸ ਮੇਰਾ ਉਹੀ ਪੇਮੈਂਟ ਦੇ ਵਿੱਚ ਤੁਹਾਨੂੰ ਸੈੱਟ ਕਰਕੇ ਦੇਣਾ ਪੈਣਾ ਹਾਂਜੀ ਉਹ ਮੈਂ ਤੁਹਾਨੂੰ ਦੇ ਕੇ ਜਾਊਂਗੀ ਅਤੇ ਫਿਰ ਮੈਨੂੰ ਇੱਕ ਦੋ ਦਿਨ ਦੇ ਵਿੱਚ ਉਹ ਠੀਕ ਕਰਕੇ ਦੇ ਦਿਓ ਅਤੇ ਮੈਂ ਤੁਹਾਨੂੰ ਕੱਲ ਫੜਾ ਜੁੰਗੀ ਜੀ ਹਾਂਜੀ ਠੀਕ ਹੈ ਜੀ ਕੋਈ ਗੱਲ ਨਹੀਂ ਜਦੋਂ ਤੁਸੀਂ ਆ ਗਏ ਤਾਂ ਮੈਨੂੰ ਕਾਲ ਕਰ ਦਿਓ ਅਤੇ ਮੈਂ ਤੁਹਾਨੂੰ ਮੈਂ ਉਹ ਫੜਾ ਜੂੰਗੀ ਅਤੇ ਉਹ ਕੱਪੜਾ ਲੱਭ ਕੇ ਰੱਖ ਲਿਓ ਗਰੀਨ ਕਲਰ ਦਾ ਸੀ ਉੱਤੇ ਕੋਈ ਚਲੋ ਡਿਜ਼ਾਇਨ ਵਗੈਰਾ ਕਰ ਲਵਾਂਗੇ ਡੀਜਾਇਨਿੰਗ ਜਿਹੀ ਅਤੇ ਹਾਂਜੀ ਹਾਂਜੀ ਉਹ ਸੈਟਿੰਗ ਕਰਕੇ ਮੈਨੂੰ ਦੇ ਦਿਓ ਅਤੇ ਹਾਂਜੀ ਮੈਮ ਹੋਰ ਜੀ ਬਸ ਠੀਕ ਹੈ ਜੀ ਓਕੇ ਜੀ ਬਾਏ ਓਕੇ ਬਾਏ ਜੀ